ਸ ਸਾਨੂੰ ਸਵੇਰੇ ਸਵੇਰੇ ਮੰਦਰ ਜਾ ਕੇ ਬਹੁਤ ਖੁਸ਼ੀ ਮਿਲਦੀ ਹੈ ਜਿਸ ਮੰਦਰ ਜਾਈਦਾ ਉੱਥੇ ਜਾ ਕੇ ਪਾਠ ਪੂਜਾ ਕਰੀਦੀ ਹੈ ਬੈਠ ਕੇ ਸਫਾਈ ਕਰੀਦੀ ਹੈ ਮੰਦਰ ਦੀ ਮੰਦਰ ਵਿੱਚ ਬੈਠ ਕੇ ਭਜਨ ਬੋਲੀ ਦੇ ਹੈ ਭਜਨ ਸੁਣੀ ਦੇ ਹੈ ਪਰਮਾਤਮਾ ਦਾ ਨਾਮ ਲੈਣ ਨਾਲ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਕਰਕੇ ਅਸੀਂ ਪਰਮਾਤਮਾ ਦੇ ਭਜਨ ਸੁਣੀਦੇ ਹੈ ਅਤੇ ਆਪਣੇ ਕੰਮਕਾਰ 'ਤੇ ਬੈਠ ਕੇ ਵੀ ਭਜਨ ਸੁਣੀਦੇ ਜਿਸ ਨਾਲ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਅਤੇ ਆਤਮਾ ਨੂੰ ਵੀ ਸ਼ਾਂਤੀ ਮਿਲਦੀ ਹੈ ਅਤੇ ਆਪਣਾ ਜਿੱਥੇ ਵੀ ਜਾਈਏ ਆਪਾਂ ਲੋਕਾਂ ਨਾਲ ਪਰਮਾਤਮਾ ਦਾ ਨਾਮ ਹੀ ਲੈਂਦੇ ਹਨ ਜਿਸ ਕਰਕੇ ਪਰਮਾਤਮਾ ਵੀ ਖੁਸ਼ ਅਤੇ ਆਪਾਂ ਵੀ ਖੁਸ਼ ਹੋਰ ਸਾਨੂੰ ਖਾਣ ਪੀਣ ਤੱਕ ਸੌਂਕ ਹੈ ਖਾਣ ਪੀਣ ਨਾਲ ਬਹੁਤ ਖੁਸ਼ੀ ਮਿਲਦੀ ਹੈ ਪੰਜਾਬੀ ਗਾਣੇ ਸੁਣਨ ਨਾਲ ਬਹੁਤ ਖੁਸ਼ੀ ਮਿਲਦੀ ਹੈ ਪ ਪੁਰਾਣੇ ਗਾਣੇ ਹਿੰਦੀ ਸੁਣਨ ਨਾਲ ਬਹੁਤ ਖੁਸ਼ੀ ਮਿਲਦੀ ਹੈ ਪਰਿਵਾਰ ਨਾਲ ਬੈਠ ਕੇ ਗੱਲਾਂ ਕਰਨ ਨਾਲ ਵੀ ਬਹੁਤ ਖੁਸ਼ੀ ਮਿਲਦੀ ਹੈ ਰਿਸ਼ਤੇਦਾਰੀ 'ਚ ਜਾ ਕੇ ਅਸੀਂ ਬਹੁਤ ਖੁਸ਼ੀ ਮਨਾਉਂਦੇ ਹਨ ਜੇ ਕੋਈ ਸਾਡੇ ਘਰ ਆ ਜਾਵੇ ਉਸਨੂੰ ਮਿਲ ਕੇ ਵੀ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਯਾਰਾਂ ਦੋਸਤਾਂ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਅਸੀਂ ਬਾਹਰ ਜਾਈਏ ਆਪਾਂ ਮਿਲ ਜੁਲ ਕੇ ਖਾਈਏ ਉਹਦੇ ਨਾਲ ਹੀ ਬਹੁਤ ਖੁਸ਼ੀ ਮਿਲਦੀ ਹੈ ਦੂਜਿਆਂ ਨੂੰ ਖਿਲਾਉਣ ਨਾਲ ਦਿਲ ਨੂੰ ਖਾਸ਼ ਖੁਸ਼ੀ ਮਿਲਦੀ ਹੈ ਜਿਸ ਕਰਕੇ ਬੰਦਾ ਆਏ ਸਾਡੇ ਨਾਲ ਬੈਠ ਕੇ ਖਾਓ ਪੀਓ ਐਸ਼ ਕਰੋ ਅਤੇ ਅਰਾਮ ਨਾਲ ਰਹੋ ਦੂਜੇ ਨਾਲ ਖੁਸ਼ੀ ਲੈ ਕੇ ਆਪਾਂ ਵੀ ਖੁਸ਼ ਹਾਂ ਅਤੇ ਦੂਜਾ ਵੀ ਖੁਸ਼ ਰਹਿੰਦਾ ਹੈ